ਜੀ ਹਾਂ ਸਾਡੇ ਹੋਸਪਿਟਲ ਗੁਰਦਾਸਪੁਰ ਦਾ ਬਬਰੀ ਬਾਈਪਾਸ 'ਤੇ ਹੈ ਜੇ ਤਾਂ ਆਪਣਾ ਸਾਧਨ ਹੋਏ ਫਿਰ ਤਾਂ ਬੰਦਾ ਉੱਥੇ ਆਰਾਮ ਨਾਲ ਪੁੱਛ ਸਕਦਾ ਜੇਕਰ ਨਹੀਂ ਤਾਂ ਸਪੈਸ਼ਲ ਉੱਥੇ ਕੋਈ ਸ ਆਪਣਾ ਸ ਕਰਾਉਣਾ ਪੈਂਦੀ ਸਾਲਮ ਸਵਾਰੀ ਕਰਾਉਣੀ ਪੈਂਦੀ ਆ ਜੇ ਆਪਾਂ ਕਹੀਏ ਕਿ ਜਿਹੜੇ ਥਰੀ ਵੀਲਰ ਜਾਂਦੇ ਆ ਥਰੀ ਵੀਲਰ ਜੇ ਜਾਂਦੇ ਆ ਤਾਂ ਉਹ ਸੜਕ 'ਤੇ ਉਤਾਰ ਦਿੰਦੇ ਆ ਸੜਕ ਤੋਂ ਲਗਭਗ ਪੰਜ ਸੌ ਛੇ ਸੌ ਮੀਟਰ ਅੱਗੇ ਪੈਦਲ ਤੁਰਨਾ ਪੈਂਦਾ ਜਿਹੜਾ ਬੰਦਾ ਬਿਚਾਰਾ ਮਾਤੜ ਆ ਉਹ ਕਿੱਦਾਂ ਉੱਥੋਂ ਤੁਰ ਕੇ ਜਾਏਗਾ ਪੈਦਲ ਉਹ ਤਾਂ ਹੋਰ ਬਿਮਾਰ ਹੋ ਜਾਏਗਾ ਤੁਰਨ ਨਾਲ ਕਤਾਰਾਂ ਤਾਂ ਦੇਖੋ ਜੀ ਹਸਪਤਾਲ ਹੁਣ ਸਰਕਾਰੀ ਆ ਜਿੰਨੇ ਬਿਚਾਰੇ ਹੈਗੇ ਆ ਲੋਕ ਅੱਜ ਕੱਲ੍ਹ ਡਾਕਟਰ ਵਧੀਆ ਹੋਣ ਕਰਕੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਹੀ ਜਾਂਦੇ ਆ ਅਤੇ ਉਹ ਤਾਂ ਚਲੋ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਲੰਬੀਆਂ ਲਾਈਨਾਂ ਲੱਗੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਣ ਇਹ ਤਾਂ ਚਲੋ ਥੋੜ੍ਹਾ ਬਹੁਤ ਤਾਂ ਦੇਖਣਾ ਪੈਂਦਾ ਹੀ ਆ ਹਾਂ ਬਸ ਇਲਾਜ ਬੰਦੇ ਦਾ ਸਹੀ ਤਰੀਕੇ ਨਾਲ ਚੱਲ ਪਏ ਅਤੇ ਕੋਈ ਚੱਕਰ ਨਹੀਂ ਆ ਬਸ ਮਾੜਾ ਇਹੋ ਹੀ ਆ ਜੀ ਜਦੋਂ ਇੱਥੋਂ ਸ਼ਹਿਰ ਤੋਂ ਬਾਹਰ ਚਲਾ ਗਿਆ ਹੋਸਪੀਟਲ ਸ਼ਹਿਰ ਦੇ ਵਿੱਚ ਕੋਈ ਹੈਗਾ ਨਹੀਂ ਆ ਸਰਕਾਰੀ ਅਤੇ ਉਹ ਜਾਣ ਦੇ ਚੱਕਰ 'ਚ ਜਾਂ ਤਾਂ ਫਿਰ ਸਾਧਨ ਕਰਾਉਣਾ ਪੈਂਦਾ ਕੋਈ ਆਪਣਾ ਅਤੇ ਫਿਰ ਹੀ ਬੰਦਾ ਜਾ ਸਕਦਾ ਵਾ ਜੇ ਕਹੋ ਕਿ ਕੋਈ ਆਮ ਬੰਦਾ ਚਲ ਜਾਏ ਸਿੱਧਾ ਉਹ ਨਹੀਂ ਜਾ ਸਕਦਾ ਜੀ ਉਹ ਓਨੇ 'ਚ ਹੀ ਜਿਹੜੇ ਥਰੀ ਵੀਲਰ ਜਾਂਦੇ ਆ ਉਹ ਸੜਕ 'ਤੇ ਉਤਾਰ ਦਿੰਦੇ ਆ ਅੱਗੋਂ ਫਿਰ ਤੁਹਾਨੂੰ ਪੈਦਲ ਜਾ ਕੇ ਓਨੇ ਤੁਹਾਨੂੰ ਵੈਸੇ ਜੇ ਬੰਦਾ ਕਿਸੇ ਦਾ ਬਲੱਡ ਪ੍ਰੈਸ਼ਰ ਵਧਿਆ ਹੋਏ ਅਤੇ ਤੁਰਨ ਨਾਲ ਹੋਰ ਵਧ ਜਾਣਾ ਜੇ ਢਿੱਡ ਪੀੜ ਹੁੰਦੀ ਹੈ ਬਿਚਾਰੇ ਤੋਂ ਤੁਰਿਆ ਨਹੀਂ ਜਾਣਾ ਵੈਸੇ ਚਾਹੀਦਾ ਇਹਨਾਂ ਨੂੰ ਕਿ ਕੋਈ ਇਹੋ ਜਿਹਾ ਉੱਥੇ ਰੱਖਣ ਨੂੰ ਜਿਹੜੀ ਫਰੀ ਗੱਡੀਆਂ ਲਾ ਦੇਣੀਆਂ ਚਾਹੀਦੀਆਂ ਇਹਨਾਂ ਨੂੰ ਕੋਈ ਉੱਥੇ ਜੋ ਸੜਕ ਤੋਂ ਹਸਪਤਾਲ ਦੇ ਅੰਦਰ ਤੱਕ ਦੀ ਫਰੀ ਸਵਾਰੀ ਹੈ ਜਿੱਦਾਂ ਪੀ ਜੀ ਆਈ ਦੇ ਵਿੱਚ ਚਲਦੇ ਆ ਈ ਰਿਕਸ਼ਾ ਵਗੈਰਾ ਉਸੇ ਤਰ੍ਹਾਂ ਇੱਥੇ ਵੀ ਕੁਛ ਇਹੋ ਜਿਹਾ ਹੋਣਾ ਚਾਹੀਦਾ ਇੱਥੇ ਨਹੀਂ ਕਿ ਹਰ ਇੱਕ ਸਰਕਾਰੀ ਹਸਪਤਾਲ 'ਚ ਹੋਣਾ ਚਾਹੀਦਾ ਕਿ ਬ ਉਹ ਜਿਹੜਾ ਸੜਕ ਤੋਂ ਜਾਣ ਤੱਕ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਏ ਕਿਉਂਕਿ ਜਿਹੜੇ ਬਜ਼ੁਰਗ ਆ ਬਜ਼ੁਰਗ ਬਿਚਾਰੇ ਕਿੰਨਾ ਕੁ ਚੱਲਣਗੇ ਅਤੇ ਅੱਜ ਕੱਲ੍ਹ ਲੋਕਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਲੋਕ ਆਪਾਂ ਆਪ ਦੇਖਦੇ ਹਾਂ ਕਿ ਬਜ਼ੁਰਗ ਬਿਚਾਰੇ ਆਪੇ ਤੁਰੇ ਹੁੰਦੇ ਆ ਨਾਲ ਉਹਨਾਂ ਦੇ ਕੋਈ ਹੁੰਦਾ ਨਹੀਂ ਕੀ ਕਰਨਗੇ ਉਹ ਬਿਚਾਰੇ ਕਿੱਦਾਂ ਚੱਲਣਗੇ ਇਸ ਕਰਕੇ ਕੋਈ ਸਾਧਨਾ ਦੀ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਮੁਹੱਈਆ ਮਦਦ ਮੁਹੱਈਆ ਹੋਣੀ ਚਾਹੀਦੀ ਹੈ ਜੀ ਧੰਨਵਾਦ ਜੀ